ਦੇਖੋ ਜੀ ਵੱਖ ਵੱਖ ਮੌਸਮਾਂ ਦਾ ਆਪੋ ਆਪਣਾ ਮਜ਼ਾ ਔਰ ਸਰਦੀਆਂ ਦੇ ਵਿੱਚ ਧੁੱਪੇ ਬੈਠ ਕੇ ਚਾਹ ਪੀਣੀ ਮੂੰਗਫਲੀ ਖਾਣੀ ਅਤੇ ਰਿਉੜੀਆਂ ਖਾਣੀਆਂ ਇਹਦਾ ਆਪਣਾ ਆਨੰਦ ਹੈ ਉੱਥੇ ਬੈਠਿਆਂ ਨੇ ਕਈ ਵਾਰੀ ਕੋਈ ਪਕੌੜੇ ਵਗੈਰਾ ਬਣ ਕੇ ਆ ਗਿਆ ਉਹ ਵੀ ਖਾ ਲੈਣੇ ਅਤੇ ਇਸੇ ਤਰ੍ਹਾਂ ਗਰਮੀਆਂ ਦੇ ਵਿੱਚ ਅਤੇ ਸਰਦੀਆਂ ਦੇ ਵਿੱਚ ਹੋਰ ਵੀ ਹੈ ਕਿ ਕਈ ਵਾਰੀ ਘਰ ਦੇ ਵਿੱਚ ਪਿੰਨੀਆਂ ਬਣਾਈਆਂ ਹੁੰਦੀਆਂ ਇਹ ਸਾਡੇ ਰਿਵਾਇਤੀ ਖਾਣਾ ਆ ਇਹ ਪਿੰਨੀਆਂ ਬਣਾਉਣੀਆਂ ਉਹ ਆਟੇ ਤੋਂ ਅਲਸੀ ਤੋਂ ਉਹਦੇ ਵਿੱਚ ਡਰਾਈ ਫਰੂਟ ਪਾ ਦੇਣੇ ਉਹ ਬਣਾ ਕੇ ਦਾਦੀ ਨੇ ਬਣਾਉਣੀਆਂ ਜਾਂ ਮੰਮੀ ਨੇ ਬਣਾਉਣੀਆਂ ਉਹ ਸਿਆਣਿਆਂ ਨੇ ਬਣਾ ਕੇ ਦੇਣੀ ਉਹ ਵੀ ਸਰਦੀਆਂ ਦੇ ਵਿੱਚ ਧੁੱਪ 'ਚ ਬੈਠ ਕੇ ਖਾਣੀਆਂ ਉਹ ਉਹਦਾ ਆਨੰਦ ਲੈਣਾ ਇੱਦਾਂ ਹੀ ਗਰਮੀਆਂ ਦੇ ਵਿੱਚ ਵੀ ਫਲ ਫਰੂਟ ਖਾ ਜਿਹੜੇ ਉਹ ਕੱਟ ਕੇ ਗਰਮੀਆਂ ਦੇ ਵਿੱਚ ਉਹ ਹਦਵਾਣਾ ਖਰਬੂਜ਼ਾ ਅੰਬ ਇਹ ਬਹੁਤ ਸਾਰੇ ਫ਼ਲ ਹੁੰਦੇ ਆ ਇਹਨਾਂ ਦਾ ਵੀ ਆਨੰਦ ਲੈਂਦੇ ਆ ਬਹੁਤ ਵਧੀਆ ਬੈਠ ਕੇ ਅਸੀਂ ਅਤੇ ਚਾਹ ਕੌਫ਼ੀ ਹੈ ਉਹਦੇ ਨਾਲ ਕਈ ਵਾਰੀ ਪਕੌੜੇ ਵੀ ਬਣ ਜਾਂਦੇ ਆ ਪੰਜਾਬ ਦੇ ਵਿੱਚ ਜਿਹੜਾ ਗਰਮੀਆਂ ਦੇ ਵਿੱਚ ਖਾਣ ਨੂੰ ਅਤੇ ਸਰਦੀਆਂ ਦੇ ਵਿੱਚ ਵੀ ਖਾਣ ਨੂੰ ਬਹੁਤ ਵਧੀਆ ਜਿਹੜਾ ਅਸੀਂ ਖਾ ਕੇ ਮਜ਼ੇ ਲੈਂਦੇ ਹਾਂ